ਹੈਲੋ ਸਰ ਤੁਸੀਂ ਮੀਸ਼ੋ ਤੋਂ ਬੋਲ ਰਹੇ ਹੋ ਹਾਂਜੀ ਸਰ ਅਸੀਂ ਤੁਹਾਡੇ ਕੋਲੋਂ ਪ੍ਰੋਡਕਟ ਮੰਗਵਾਇਆ ਸੀ ਬੈੱਡ ਸ਼ੀਟ ਇੱਕ ਸੈੱਟ ਚਾਦਰ ਦਾ ਅਤੇ ਉਹ ਸਾਡੇ ਕੋਲ ਪਹੁੰਚ ਚੁੱਕਾ ਹੈ ਅਸੀਂ ਦੇਖ ਲਿਆ ਹੈ ਤਾਂ ਸਾਨੂੰ ਬਹੁਤ ਪਸੰਦ ਹੈ ਕਲਰ ਰੰਗ ਵੀ ਬਹੁਤ ਸੋਹਣੇ ਹਨ ਅੱਛਾ ਚਲੋ ਧੋ ਕੇ ਦੇਖ ਲਿਆ ਹੈ ਉਸਦਾ ਰੰਗ ਵੀ ਨਹੀਂ ਉਤਰਿਆ ਅਤੇ ਬਹੁਤ ਵਧੀਆ ਕੱਪੜਾ ਰਿਹਾ ਵਾ ਪ੍ਰਿੰਟ ਬਹੁਤ ਸੋਹਣਾ ਵਾ ਜਿਹੋ ਜਿਹਾ ਮਤਲਬ ਦੇਖਿਆ ਸੀਗਾ ਫੋਨ 'ਤੇ ਸੇਮ ਉਹ ਉਵੇਂ ਦਾ ਸੀ ਰੰਗ ਸੀ ਉਵੇਂ ਦੇ ਪ੍ਰਿੰਟ ਸੀਗੇ ਅਤੇ ਬਹੁਤ ਸੋਹਣੀ ਚਾਦਰ ਆ ਕੱਪੜਾ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਅਤੇ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਹੈ ਜੋ ਕਿ ਸਾਡੇ ਘਰ ਵਿੱਚ ਪੜਦਿਆਂ ਦੇ ਨਾਲ ਮੈਚ ਕਰ ਰਿਹਾ ਸੀ ਅਤੇ ਮਤਲਬ ਬਹੁਤ ਸੋਹਣਾ ਲੱਗ ਰਿਹਾ ਵਿਛਾਉਣ ਨੂੰ ਅਸੀਂ ਮਤਲਬ ਹੋਰ ਮੰਗਵਾਵਾਂਗੇ ਤੁਹਾਡੇ ਕੋਲੋਂ ਅਤੇ ਸਾਨੂੰ ਹੋਰ ਭੇਜ ਦਿਓ ਅਸੀਂ ਤੁਹਾਨੂੰ ਆਹ ਨੂੰ ਕਿਸ ਮਤਲਬ ਆਪਣੇ ਆਂਢ ਗੁਆਂਢ ਵਿੱਚ ਵੀ ਕਿਸੇ ਨੇ ਪੁੱਛਿਆ ਸੀ ਕਿ ਚਾਦਰ ਬੈੱਡ ਸ਼ੀਟ ਕਿੱਥੋਂ ਲਈ ਹੈ ਅਤੇ ਮੈਂ ਉਹਨਾਂ ਨੂੰ ਬੋਲਿਆ ਸੀ ਕਿ ਮੀਸ਼ੋ ਤੋਂ ਮੰਗਵਾਈ ਹੋਈ ਆ ਉਹਨਾਂ ਨੇ ਵੀ ਕਿਹਾ ਹੈ ਕਿ ਸਾਨੂੰ ਵੀ ਮੰਗਵਾ ਦਿਓ ਅਤੇ ਤੁਹਾਡੀ ਬੈੱਡ ਸ਼ੀਟ ਬਹੁਤ ਹੀ ਜ਼ਿਆਦਾ ਪਸੰਦ ਆਈ ਆ ਸਭਨਾ ਨੂੰ

ਹਾਂਜੀ ਅਤੇ ਸਰ ਸਾਨੂੰ ਬਹੁਤ ਜ਼ਿਆਦਾ ਪਸੰਦ ਆਈ ਚਾਦਰ ਅਸੀਂ ਤੁਹਾਡੇ ਕੋਲੋਂ ਹੋਰ ਮੰਗਵਾਉਣਾ ਚਾਹੁੰਦੇ ਹਾਂ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ